ਆਕਾਸ਼ੀ ਘਟਨਾ ਆਕਾਸ਼ੀ ਘਟਨਾ ਵਿੱਚ ਜਿਵੇਂ ਕਿ ਆਕਾਸ਼ੀ ਘਟਨਾ ਚੰਦਰ ਗ੍ਰਹਿਣ ਲੱਗਣਾ ਅਤੇ ਚੰਦਰ ਗ੍ਰਹਿਣ ਵਾਲੇ ਦਿਨ ਜਿਵੇਂ ਕਿ ਗਰਭਵਤੀ ਮ ਮਹਿਲਾ ਨੂੰ ਚੰਦਰਮਾ ਗ੍ਰਹਿਣ ਲੱਗਦਾ ਹੈ ਤਾਂ ਉਦੋਂ ਬਾਹਰ ਨਹੀਂ ਨਿਕਲ ਦਿੱਤਾ ਜਾਂਦਾ ਅਤੇ ਇਹ ਮੰਨਣਾ ਹੈ ਕਿ ਅਗਰ ਜੇ ਚੰਦਰਮਾ ਗ੍ਰਹਿਣ ਲੱਗਿਆ ਹੋਵੇ ਤਾਂ ਬੱਚੇ ਦਾ ਕੋਈ ਨਾ ਕੋਈ ਅੰਗ ਪੈਰ ਜੋ ਹੈ ਉਹ ਪੂਰਾ ਨਹੀਂ ਹੋ ਪਾਂਦਾ ਇਸ ਕਰਕੇ ਗਰਭਵਤੀ ਮਹਿਲਾ ਨੂੰ ਚੰਦਰਮ ਚੰਦਰਮਾ ਗ੍ਰਹਿਣ ਲੱਗਣ 'ਤੇ ਬਾਹਰ ਨਹੀਂ ਨਿਕਲ ਦਿੱਤਾ ਜਾਂਦਾ ਚੰਦ ਆਕਾਸ਼ ਦੇ ਵਿੱਚ ਜਿਵੇਂ ਕਿ ਤਾਰਾ ਟੁੱਟਦਾ ਬਹੁਤ ਵਾਰ ਦੇਖਿਆ ਗਿਆ ਹੈ ਅਤੇ ਸੂਰਜ ਵੀ ਉੱਗਦਾ ਸਵੇਰੇ ਸਵੇਰੇ ਬਹੁਤ ਵਾਰ ਦੇਖਦੇ ਹਾਂ ਅਤੇ ਸੂਰਜ ਨੂੰ ਆਕਾਸ਼ ਵਿੱਚ ਸ਼ਾਮ ਦੇ ਸਮੇਂ ਛਿਪਦਾ ਵੀ ਅਸੀਂ ਬਹੁਤ ਵਾਰ ਦੇਖਦੇ ਹਾਂ